ਅੱਜ ਦੇ ਸਮੇਂ ਵਿੱਚ ਖੇਡਾਂ ਸਿਰਫ਼ ਸ਼ਹਿਰੀ ਲੋਕਾਂ ਦਾ ਕੰਮ ਨਹੀਂ ਹੈ ਇਹ ਪਿੰਡਾਂ ਦੇ ਲੋਕਾਂ ਲਈ ਵੀ ਬਹੁਤ ਅਹਿਮ ਚੀਜ਼ ਬਣ ਗਈ ਹੈ ਪਹਿਲੇ ਤਾਂ ਪਿੰਡਾਂ ਦੇ ਲੋਕ ਇਹ ਸਿਰਫ਼ ਮਨੋਰੰਜਨ ਲਈ ਖੇਡਦੇ ਸੀ ਪਰ ਅੱਜ ਦੇ ਸਮੇਂ ਵਿੱਚ ਨਾ ਸਿਰਫ਼ ਮਜੋਰਨ ਮਨੋਰੰਜਨ ਬਲਕਿ ਪੈਸੇ ਦਾ ਵੀ ਇੱਕ ਬਹੁਤ ਵੱਡਾ ਸਾਧਨ ਹੈ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਿਭਿੰਨ ਵਿਭਿੰਨ ਤਰ੍ਹਾਂ ਦੇ ਟੂਰਨਾਮੈਂਟ ਹੋ ਰਹੇ ਹਨ ਜਿਵੇਂ ਕਿ ਇੱਕ ਤਾਂ ਆਈ ਪੀ ਐਲ ਹੈ ਇੱਕ ਰਣਜੀ ਹੈ ਹੋਰ ਵੀ ਬਹੁਤ ਡੋਮੈਸਟਿਕ ਹੋ ਰਹੇ ਨੇ ਜਿਸ ਵਿੱਚ ਬੰਦੇ ਜਿਹੜੇ ਹੈ ਆਮ ਪਿੰਡਾਂ ਤੋਂ ਚੁੱਕੇ ਜਾਂਦੇ ਹਨ ਆਮ ਪਿੰਡਾਂ ਵਿੱਚ ਲੋਕਾਂ ਦਾ ਇਹ ਬਹੁਤ ਵਰਗਾ ਸਾਧਨ ਹੈ ਇੱਕ ਦੂਜੇ ਨਾਲ ਮਿਲਣ ਦਾ ਗੱਲਾਂ ਬਾਤਾਂ ਕਰਨਾ ਇਸ ਨਾਲ ਲੋਕ ਇੱਕ ਦੂਜੇ ਨੂੰ ਜਾਣਦੇ ਵੀ ਹਨ ਅਤੇ ਸਮਾਜਿਕ ਤੌਰ 'ਤੇ ਵੀ ਇੱਕ ਦੂਜੇ ਨਾਲ ਸਮਰੱਥਾ ਬਹੁਤ ਵੱਧਦੀ ਹੈ ਬੰਦਿਆਂ ਦਾ ਪਿਆਰ ਆਪਸ ਵਿੱਚ ਬਹੁਤ ਵੱਧਦਾ ਹੈ ਤੋ ਇੱਕ ਦੂਜੇ ਨਾਲ ਮੇਲ ਜੋਲ ਵੀ ਰੱਖਦੇ ਹਨ ਕਿਉਂਕਿ ਗੇਮਾਂ ਰਾਹੀਂ ਉਹ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਨਾਲ ਡੱਟ ਕੇ ਖੜ੍ਹੇ ਹੋਣਾ ਅਤੇ ਇੱਕ ਦੂਜੇ ਨਾਲ ਮੁਸੀਬਤ ਦੇ ਸਮੇਂ ਇਕੱਠੇ ਹੋ ਕੇ ਲੜਨ ਲਈ ਤਿਆਰ ਹੋ ਜਾਂਦੇ ਹਨ ਕਿਉਂਕਿ ਖੇਡਾਂ ਬੰਦੇ ਨੂੰ ਸਿਖਾਉਂਦੀਆਂ ਹਨ ਕਿ ਕਿਵੇਂ ਦੋ ਬੰਦੇ ਇੱਕ ਚੀਜ਼ ਨਾਲ ਇੱਕ ਸਮੇਂ 'ਤੇ ਵਧੀਆ ਤਰੀਕੇ ਨਾਲ ਲੜ ਸਕਦੇ ਹਨ ਅਤੇ ਖੇਡਾਂ ਬੰਦੇ ਨੂੰ ਮਾਨਸਿਕ ਤੌਰ 'ਤੇ ਵੀ ਬਹੁਤ ਤਿਆਰ ਕਰਦੀਆਂ ਹਨ ਅਤੇ ਪਿੰਡਾਂ ਵਿੱਚ ਬੰਦੇ ਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਦੀ ਦਿਨ ਚਰਿਆ ਵਿੱਚ ਇੰਨੇ ਤੇ ਉਹਨੂੰ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਉਹਨਾਂ ਤੋਂ ਲੜਨ ਲਈ ਉਹਨੂੰ ਹਮੇਸ਼ਾ ਤਿਆਰ ਰਹਿਣਾ ਪੈਂਦਾ ਹੈ